ਹਾਂਜੀ ਮੈਂ ਦੂਸਰੀਆਂ ਗੈਲਰੀਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਦੀ ਹਾਂ ਤਾਂਕਿ ਉੱਥੇ ਮੈਂ ਜੋ ਉਨ੍ਹਾਂ ਦੇ ਬਣਾਏ ਹੋਲਾ ਹੋਈਆਂ ਕਲਾ ਕ੍ਰਿਤਾਂ ਹੈ ਉਹਨਾਂ ਨੂੰ ਦੇਖਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਵਾਚਾਂ ਅਤੇ ਜੋ ਮੇਰੇ 'ਚ ਕਮੀਆਂ ਮੈਂ ਉਨ੍ਹਾਂ ਨੂੰ ਦੂਰ ਕਰਾਂ ਅਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਵੀ ਜਾਂਦੀ ਹਾਂ ਅਤੇ ਉਨ੍ਹਾਂ ਦੇ ਕਿਸੇ ਕਲਾ ਕ੍ਰਿਤੀ ਬਾਰੇ ਉਨ੍ਹਾਂ ਤੋਂ ਪੁੱਛਦੀ ਹਾਂ ਕਿ ਤੁਹਾਡੇ ਮਨ 'ਚ ਕੀ ਵਿਚਾਰ ਆਏ ਤੁਸੀਂ ਇਹ ਬਣਾਈ ਆ ਤੁਹਾਡੇ ਅ ਉਨ੍ਹਾਂ ਦੇ ਕੀ ਖਾਸ ਵਿਸ਼ੇਸਤਾਂ ਕੀ ਹੈ ਤਾਂ ਮੈਂ ਉਨ੍ਹਾਂ ਤੋਂ ਪੁੱਛ ਕੇ ਅਤੇ ਆਪਣੀ ਜੋ ਪੇਂਟਿੰਗ ਹੈ ਉਹਦੇ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ ਕਰਦੀ ਹਾਂ